ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਸ਼ਰਨਪ੍ਰੀਤ ਕੌਰ ਬੋਲ਼ ਰਹੀ ਹਾਂ ਜੀ ਮੈਂ ਨਾ ਨਵੀਂ ਨਵੀਂ ਮੋਹਾਲੀ 'ਚ ਆਈ ਹਾਂ ਅਤੇ ਮੈਂ ਇੱਕ ਦਿਨ ਲਈ ਮੋਹਾਲੀ ਦਾ ਟ੍ਰਿਪ ਪੂਰਾ ਘੁੰਮਣਾ ਚਾਹੁੰਦੀ ਹਾਂ ਅਤੇ ਮੈਨੂੰ ਨਾ ਮੋਹਾਲੀ ਬਾਰੇ ਪਤਾ ਨਹੀਂ ਹੈਗਾ ਇੰਨਾ ਜ਼ਿਆਦਾ ਕੁਛ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਮੋਹਾਲੀ 'ਚ ਘੁੰਮਣ ਫਿਰਨ ਦੀਆਂ ਜਗ੍ਹਾ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਅਤੇ ਘੁੰਮਣ ਫਿਰਨ ਨੂੰ ਜਿਵੇਂ ਆਪਾਂ ਸੜਕਾਂ 'ਤੇ ਆਪਾਂ ਆਪਣੀ ਕਾਰ ਲੈ ਕੇ ਜਾਣਾ ਹੋਵੇ ਅਤੇ ਘੁੰਮਣ ਫਿਰਨ ਲਈ ਸੜਕਾਂ ਵਗੈਰਾ ਕਿਵੇਂ ਦੀਆਂ ਨੇ ਜੀ ਠੀਕ ਹੈ ਜੀ ਅਤੇ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਘੁੰਮਣ ਫਿਰਨ

ਓਕੇ ਜੀ ਓਕੇ ਠੀਕ ਹੈ ਓਕੇ ਜੀ ਓਕੇ ਜੀ